ਭਾਰਤ ਵਿੱਚ ਲੋਕੀਂ ਅਲੱਗ ਅਲੱਗ ਰਾਜ ਵਿੱਚ ਆਪਣੀ ਆਪਣੀ ਪਸੰਦੀਦਾ ਦਾ ਭੋਜਨ ਖਾਂਦੇ ਹਨ ਪਰ ਇੱਕ ਸਮਾਨਤਾ ਹੈ ਕਿ ਭਾਰਤ ਵਿੱਚ ਲੋਕ ਮਸਾਲੇਦਾਰ ਭੋਜਨ ਦਾ ਜ਼ਿਆਦਾ ਸੇਵਨ ਕਰਦੇ ਹਨ ਜਿੱਦਾਂ ਕਿ ਸਾਊਥ ਵਿੱਚ ਲੋਕ ਇਡਲੀ ਸਾਂਬਰ ਅਤੇ ਡੋਸੇ ਦਾ ਜ਼ਿਆਦਾ ਸੇਵਨ ਕਰਦੇ ਹਨ ਅਤੇ ਪੰਜਾਬ ਵਿੱਚ ਪਰੌਂਠਿਆਂ ਅਤੇ ਮੱਕੀ ਦੀ ਰੋਟੀ ਸਰ੍ਹੋਂ ਦੇ ਸਾਗ ਦਾ ਜ਼ਿਆਦਾ ਸੇਵਨ ਕਰਦੇ ਹਨ ਅਤੇ ਜੇਕਰ ਆਪਾਂ ਦਿੱਲੀ ਵੱਲ ਵਿੱਚ ਵੇਖੀਏ ਤਾਂ ਉੱਥੇ ਬੜਾ ਪਾਓ ਦੀ ਜ਼ਿਆਦਾ ਸੇਵਨ ਕਰਦੇ ਹਨ